ਪੰਜਾਬੀ ਲੋਕ ਆਪਣੀ ਪਹਿਛਾਣ ਅਤੇ ਸਬੰਧਿਤ ਦੀ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਆਪਣੀ ਭਾਸ਼ਾ ਨੂੰ ਵਰਤਦੇ ਹਨ ਜਿਵੇਂ ਕਿ ਜੇਕਰ ਉਹ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਤਾਂ ਉਹ ਬਹੁਤ ਜ਼ਿਆਦਾ ਵਰ ਨਵੇਂ ਸ਼ਬਦ ਵਰਤਦੇ ਹਾਂ ਜਿਵੇਂ ਕਿ ਸਾਡੇ ਰੂਹ ਖੁਸ਼ ਹੋ ਗਈ ਸਾਨੂੰ ਅੱਜ ਬਹੁਤ ਜ਼ਿਆਦਾ ਸੁਆਦ ਆਇਆ ਜੇਕਰ ਉਹਨਾਂ ਨੂੰ ਕੋਈ ਵੀ ਚੀਜ਼ ਚੰਗੀ ਲੱਗਦੀ ਹੈ ਤਾਂ ਉਹ ਕਹਿ ਦਿੰਦੇ ਹਨ ਕਿ ਬਹੁਤ ਜ਼ਿਆਦਾ ਅੱਤ ਹੈ ਇਸ ਇਹਦੇ ਵਰਗਾ ਕੋਈ ਹੋਰ ਨਹੀਂ ਅਤੇ ਪੰਜਾਬੀ ਲੋਕ ਪੰਜਾਬੀ ਭਾਸ਼ਾ ਵਿੱਚ ਬਹੁਤ ਜ਼ਿਆਦਾ ਮਿਠਾਸ ਹੈ ਜੇਕਰ ਲੋਕ ਇੱਕ ਦੂਜੇ ਨਾਲ ਲੜਦੇ ਵੀ ਹਨ ਅਤੇ ਗੱਲ ਫੀਲ ਨਹੀਂ ਹੁੰਦੀ ਕਿ ਉਹ ਲੜ ਰਹੇ ਹਨ ਕਿ ਉਹ ਗਾਲਾਂ ਕੱਢ ਰਹੇ ਹਨ ਕਿਉਂਕਿ ਉਹਨਾਂ ਦੀਆਂ ਗਾਲਾਂ ਵਿੱਚ ਵੀ ਬਹੁਤ ਜ਼ਿਆਦਾ ਮਿਠਾਸ ਹੁੰਦੀ ਹੈ ਪੰਜਾਬ ਦੇਸ਼ਾਂ ਵਿਦੇਸ਼ਾਂ ਦੇ ਲੋਕ ਪੰਜਾਬੀ ਭਾਸ਼ਾ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਕਿਉਂਕਿ ਇਸ ਵਿੱਚ ਬਹੁਤ ਜ਼ਿਆਦਾ ਮਿਠਾਸ ਹੈ ਲੋਕ ਇਸ ਨੂੰ ਜਦੋਂ ਵੀ ਸੁਣਦੇ ਹਨ ਭਾਵੇਂ ਉਹਨਾਂ ਨੂੰ ਪੰਜਾਬੀ ਸਮਝ ਨਾ ਆਵੇ ਪਰ ਉਹ ਫਿਰ ਵੀ ਪੰਜਾਬੀ ਭਾਸ਼ਾ ਨੂੰ ਸੁਣ ਕੇ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਹਨ ਜਿਵੇਂ ਕਿ ਕਈ ਸਿੰਗਰ ਜਿਵੇਂ ਕਿ ਦਿਲਜੀਤ ਦੁਸਾਂਝ ਦੇ ਗਾਣੇ ਸੁਣ ਕੇ ਲੋਕ ਲੋਕ ਡਿਪਰੈਸ਼ਨ ਚੋਂ ਬਹੁਤ ਲੋਕ ਬਾਹਰ ਆਏ ਹਨ ਅਤੇ ਲੋਕ ਇਹਨਾਂ ਦੇ ਗਾਣਿਆਂ ਨੂੰ ਸੁਣ ਕੇ ਨੱਚਦੇ ਹਨ ਭਾਵੇਂ ਉਹਨਾਂ ਨੂੰ ਇਹ ਭਾਸ਼ਾ ਸਮਝ ਨਾ ਆਵੇ ਮੈਂ ਇੱਕ ਵਾਰ ਆਪਣੀ ਸਹੇਲੀ ਦੇ ਘਰ ਉਹਨਾਂ ਦੇ ਵਿਆਹ 'ਤੇ ਗਈ ਸੀ ਉਹ ਉਹਨਾਂ ਦਾ ਇੱਕ ਪਰਿਵਾਰ ਫੌਰਨ ਤੋਂ ਆਇਆ ਹੋਇਆ ਸੀ ਜਿਨ੍ਹਾਂ ਨੂੰ ਪੰਜਾਬੀ ਬਿਲਕੁਲ ਵੀ ਸਮਝ ਨਹੀਂ ਆਉਂਦੀ ਸੀ ਪਰ ਫਿਰ ਵੀ ਉਹ ਦਿਲਜੀਤ ਦੁਸਾਂਝ ਦੇ ਗਾਣੇ ਲਾ ਕੇ ਨੱਚ ਰਹੇ ਸਨ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਨੱਚ ਕਿਉਂ ਰਹੇ ਹੋ ਤੁਹਾਨੂੰ ਇਹ ਪੰਜਾਬੀ ਭਾਸ਼ਾ ਸਮਝ ਆਉਂਦੀ ਹੈ ਉਹ ਕਹਿੰਦੇ ਨਹੀਂ ਸਾਨੂੰ ਪੰਜਾਬੀ ਭਾਸ਼ਾ ਸਮਝ ਨਹੀਂ ਆਉਂਦੀ ਪਰ ਫਿਰ ਵੀ ਸਾਨੂੰ ਇਹਨਾਂ ਦੇ ਗਾਣੇ ਸੁਣਨੇ ਬਹੁਤ ਜ਼ਿਆਦਾ ਚੰਗੇ ਲੱਗਦੇ ਹਨ ਸਾਨੂੰ ਇੱਕ ਸਕੂਨ ਮਿਲਦਾ ਹੈ ਜਦੋਂ ਅਸੀਂ ਪੰਜਾਬੀ ਭਾਸ਼ਾ ਨੂੰ ਸੁਣਦੇ ਹਾਂ ਧੰਨਵਾਦ